ਬਾਰਾਂ ਮਾਰਚ ਦੋ ਹਜ਼ਾਰ ਚੌਵੀ ਨੂੰ ਐਮਾਜ਼ਾਨ ਵੈਬਸਾਈਟ ਤੋਂ ਮੈਂ ਇੱਕ ਲੈਪਟੋਪ ਓਡਰ ਕੀਤਾ ਸੀ ਉਸ ਦੀ ਬਿਲਡ ਕੁਆਲਟੀ ਵੀ ਵਧੀਆ ਸੀ ਉਸ ਦੀ ਡਿਸਪਲੇਅ ਪੰਦਰਾਂ ਪੁਆਇੰਟ ਛੇ ਇੰਚ ਦੀ ਸੀ ਉਸ ਦੀ ਰੈਮ ਸੋਲਾਂ ਜੀ ਬੀ ਦੀ ਸੀ ਅਤੇ ਮੈਮਰੀ ਪੰਜ ਸੌ ਬਾਰਾਂ ਦੀ ਸੀ ਅਤੇ ਉਹ ਫਾਸਟ ਪ੍ਰੋਸੈਸਿੰਗ ਸੀ ਉਸ ਦੀ ਬੈਟਰੀ ਲਾਈਫ ਵੀ ਗੁਡ ਸੀ ਅਤੇ ਆਈ ਫਾਈਵ ਦਾ ਪ੍ਰੋਸੈਸਰ ਲੱਗੇ ਦਾ ਸੀ ਉਹਦੇ 'ਚ ਉਹ ਮਲਟੀਟਾਸਕਿੰਗ ਸੀ ਅਤੇ ਉਹ ਮੈਨੂੰ ਬਹੁਤ ਹੀ ਕੰਫਰਟੇਬਲ ਲੱਗਿਆ ਇਸ ਲਈ ਮੈਂ ਉਹਨੂੰ ਓਡਰ ਕੀਤਾ ਸੀ ਅਤੇ ਬਾਈ ਮਾਰਚ ਦੋ ਹਜ਼ਾਰ ਚੌਵੀ ਨੂੰ ਮੈਨੂੰ ਉਹ ਰਿਸੀਵ ਹੋਇਆ ਸੀ ਅਤੇ ਉਹ ਦੇਖ ਕੇ ਮੈਂ ਬਹੁਤ ਹੀ ਖੁਸ਼ ਹੋਇਆ ਕਿ ਇਸ ਲੈਪਟੋਪ ਦੇ ਨਾਲ ਮੈਨੂੰ ਇੱਕ ਮਾਊਸ ਅਤੇ ਇੱਕ ਹੈਡਫੋਨ ਦਾ ਸੈੱਟ ਨਾਲ ਫ੍ਰੀ ਗਿਫ਼ਟ 'ਚ ਦਿੱਤਾ ਗਿਆ ਅਤੇ ਉਹ ਲੈਪਟੋਪ ਮੈਂ ਆਪਣੇ ਕੋ ਕੋਲੇਜ ਦੇ ਪ੍ਰੋਜੈਕਟਸ ਅਤੇ ਕੋਡਿੰਗ ਵਾਸਤੇ ਲਿਤ ਲਿੱਤਾ ਸੀ ਅਤੇ ਉਹ ਬਹੁਤ ਹੀ ਵਧੀਆ ਨਿਕਲ ਰਿਹਾ ਹੈ ਉਸ ਲੈਪਟੋਪ ਦੀ ਬੈਟਰੀ ਲਾਈਫ ਵੀ ਬਿਲਕੁਲ ਸਹੀ ਚੱਲ ਰਹੀ ਹੈ ਅਤੇ ਲੈਪਟੋਪ ਦੀ ਡਿਸਪਲੇ ਕੁਆਲਟੀ ਵੀ ਬਹੁਤ ਹੀ ਸਹੀ ਹੈ ਅਤੇ ਲੈਪਟੋਪ ਜਿਸ ਕੰਮ ਵਾਸਤੇ ਮੈਂ ਲਿੱਤਾ ਸੀ ਉਹ ਵੀ ਉਹ ਅਰਾਮ ਨਾਲ ਹੈਂਡਲ ਕਰ ਰਿਹਾ ਹੈ ਉਹ ਬਿਲਕੁਲ ਮਲਟੀਟਾਸਕਿੰਗ ਲੈਪਟੋਪ ਹੈ ਮੈਂ ਉਹ ਲੈਪਟੋਪ ਨਾਲ ਬਹੁਤ ਹੀ ਖੁਸ਼ ਹੋਇਆ ਹਾਂ ਅਤੇ ਮੈਂ ਬਾਕੀ ਲੋਕਾਂ ਨੂੰ ਵੀ ਇਹ ਰੇਕੋਮੈਂਡ ਕਰਦਾ ਹਾਂ ਕਿ ਤੁਸੀਂ ਵੀ ਉਹ ਲੈਪਟੋਪ ਲਵੋ